ਵਿਦਿਆਰਥੀਆਂ ਨੂੰ ਸਕੂਲਾਂ ਅਤੇ ਕਾਲਜਾਂ ਵਿੱਚ ਸਟੈਂਪਫੀਲਡ ਪ੍ਰੋਗਰਾਮ ਜੋ ਚੱਲ ਰਹੇ ਹਨ ਉਹਨਾਂ ਵਿੱਚ ਵਿਦਿਆਰਥੀਆਂ ਨੂੰ ਬਹੁਤ ਲਾਭ ਹੁੰਦਾ ਹੈ ਕਿਉਂਕਿ ਕਿੱਤਾ ਮੁੱਖੀ ਕੋਰਸ ਜਿਹੜੇ ਹੈਗੇ ਹੈ ਉਹ ਤੁਹਾਡੀ ਪ੍ਰਸਨੈਲਟੀ ਨੂੰ ਨਿਖਾਰਦੇ ਹਨ ਤੁਹਾਡੇ ਵਿੱਚ ਜਿਹੜਾ ਹੈਗਾ ਉਹ ਸਕਿੱਲ ਪੈਦਾ ਕਰਦੇ ਹਨ ਜੇਕਰ ਤੁਹਾਡੇ ਵਿੱਚ ਸਕਿੱਲ ਹੋਵੇਗਾ ਤਾਂ ਤੁਸੀਂ ਕੋਈ ਵੀ ਕੰਮ ਕਰ ਸਕਦੇ ਹੋ ਤੁਹਾਡੇ ਵਿੱਚ ਕਿਸੇ ਵੀ ਪ੍ਰਕਾਰ ਦਾ ਸਕਿੱਲ ਹੋਣਾ ਬੜਾ ਜ਼ਰੂਰੀ ਹੈ ਅਸੀਂ ਬਾਹਰਲੇ ਦੇਸ਼ਾਂ ਵਿੱਚ ਵੇਖਦੇ ਹਾਂ ਕਿ ਲੋਕਾਂ ਦੇ ਕੋਲ ਸਕਿੱਲ ਹੁੰਦਾ ਹੈ ਤਾਂ ਉਹ ਆਪਣੇ ਸਕਿੱਲ ਤੋਂ ਬਹੁਤ ਜ਼ਿਆਦਾ ਪੈਸਾ ਜਿਹੜਾ ਹੈਗਾ ਉਹ ਕਮਾ ਰਹੇ ਹਨ ਇਸ ਕਰਕੇ ਸਾਨੂੰ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਜੇਕਰ ਅਜਿਹੇ ਕੋਰਸ ਸ਼ੁਰੂ ਕੀਤੇ ਜਾਂਦੇ ਹਨ ਬਹੁਤ ਸਾਰੇ ਸਕੂਲਾਂ ਦੇ ਵਿੱਚ ਅਤੇ ਕਾਲਜਾਂ ਦੇ ਵਿੱਚ ਵੋਕੇਸ਼ਨਲ ਕੋਰਸਿਜ਼ ਕਿੱਤਾ ਮੁੱਖੀ ਕੋਰਸਿਜ਼ ਆਈ ਆਈ ਟੀ ਆਈ ਦੇ ਵਿੱਚ ਜਿਵੇਂ ਉਪਲਬਧ ਹਨ ਜੇਕਰ ਇਹ ਕਿੱਤਾ ਮੋਰ ਕੋਰਸ ਵਿਦਿਆਰਥੀ ਕਰ ਲੈਂਦੇ ਹਨ ਤਾਂ ਬਹੁਤ ਹੀ ਥੋੜ੍ਹੇ ਸਮੇਂ ਦੇ ਵਿੱਚ ਉਹਨਾਂ ਦੇ ਵਿੱਚ ਸਕਿੱਲ ਪ੍ਰਾਪਤ ਹੋ ਜਾਂਦਾ ਹੈ ਜੋ ਸਕਿੱਲ ਜੇਕਰ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਤਾਂ ਉਹ ਵਧੀਆ ਆਪਣਾ ਰੁਜ਼ਗਾਰ ਜਿਹੜਾ ਹੈਗਾ ਹੈ ਉਹ ਸ਼ੁਰੂ ਕਰ ਸਕਦੇ ਹਨ ਜਾਂ ਕਿਸੇ ਦੇ ਅੰਡਰ ਰਹਿ ਕੇ ਕੰਮ ਕਰ ਸਕਦੇ ਹਨ ਥੈਂਕ ਯੂ